ਜੇਕਰ ਮੈਂ ਆਪਣੇ ਭੈਣ ਭਰਾਵਾਂ ਦੀ ਗੱਲ ਕਰਾਂ ਤਾਂ ਉਹ ਬਹੁਤ ਹੀ ਸਮਾਨ ਹਨ ਮੇਰੇ ਜਿਸ ਤਰ੍ਹਾਂ ਮੈਂ ਆਪਣੇ ਵੱਡੇ ਭਰਾ ਦੀ ਗੱਲ ਕਰਦਾ ਹਾਂ ਕਿ ਉਹ ਇੱਕ ਡਾਕਟਰ ਹੈ ਅਤੇ ਉਸ ਤੋਂ ਉਸ ਨਾਲ ਰਹਿ ਕੇ ਮੈਨੂੰ ਬਹੁਤ ਕੁਝ ਹੀ ਸਿੱਖਣ ਨੂੰ ਮਿਲਦਾ ਹੈ ਜਿਵੇਂ ਕਿ ਆਪਣੀ ਲਾਈਫ ਦੇ ਵਿੱਚ ਮਿਹਨਤ ਕਰਕੇ ਕਿਵੇਂ ਉਸ ਨੇ ਡਾਕਟਰੀ ਦੀ ਪੜ੍ਹਾਈ ਕੀਤੀ ਅਤੇ ਹੁਣ ਕਿਵੇਂ ਹੀ ਆਪਣੀ ਸਰਵਿਸ ਬਹੁਤ ਹੀ ਵਧੀਆ ਕਰ ਰਿਹਾ ਹੈ ਸਾਨੂੰ ਹਮੇਸ਼ਾ ਹੀ ਮੈਨੂੰ ਹਮੇਸ਼ਾ ਹੀ ਉਸ ਤੋਂ ਕੁਝ ਨਾ ਕੁਝ ਵੱਖਰਾ ਹੀ ਸਿੱਖਣ ਨੂੰ ਮਿਲਦਾ ਹੈ ਜਦ ਵੀ ਉਸ ਨਾਲ ਮਿਲਦਾ ਹਾਂ ਪਰ ਜੇਕਰ ਮੈਂ ਆਪਣੇ ਛੋਟੇ ਭਰਾ ਦੀ ਗੱਲ ਕਰਾਂ ਤਾਂ ਉਹ ਲਾਈਫ ਨੂੰ ਸਭ ਕੁਝ ਭੁੱਲ ਕੇ ਪੂ ਪੂਰਾ ਇੰਜੋਏ ਕਰਦਾ ਹੈ ਇਸ ਕਰਕੇ ਮੈਂ ਕਹਿ ਸਕਦਾ ਹਾਂ ਕਿ ਉਹ ਮੇਰੇ ਤੋਂ ਬਹੁਤ ਹੀ ਵੱਖਰਾ ਹੈ ਸਾਨੂੰ ਸਾਨੂੰ ਹਮੇਸ਼ਾ ਹੀ ਹਰ ਕਿਸੇ ਤੋਂ ਕੁਛ ਸਿੱਖਣਾ ਚਾਹੀਦਾ ਹੈ ਜਿਵੇਂ ਕਿ ਮੈਂ ਆਪਣੇ ਛੋਟੇ ਭਰਾ ਤੋਂ ਸਿੱਖ ਸਕਦਾ ਹਾਂ ਕਿ ਹਰ ਚੀ ਕਿ ਲਾਈਫ ਦੀ ਹਰ ਮੁਸ਼ਕਲ ਨੂੰ ਭੁੱਲ ਕੇ ਸਾਨੂੰ ਇੰਨਜੋਏ ਕਿਵੇਂ ਕਰਨਾ ਚਾਹੀਦਾ ਹੈ ਅਤੇ ਮੈਂ ਆਪਣੇ ਵੱਡੇ ਭਰਾ ਤੋਂ ਸਿੱਖਦਾ ਹਾਂ ਕਿ ਕਿਵੇਂ ਮੈਨੂੰ ਪੜ੍ਹਾਈ ਉਸ ਤੋਂ ਲੋਕਾਂ ਨਾਲ ਗੱਲ ਕਰਨੀ ਚਾਹੀਦੀ ਹੈ ਲੋਕਾਂ ਦੀ ਮ ਲੋਕਾਂ ਦਾ ਕੰਮ ਬਹੁਤ ਵਧੀਆ ਤਰੀਕੇ ਨਾਲ ਕਰਨਾ ਚਾਹੀਦਾ ਹੈ ਆਪਣੀ ਪੂਰੀ ਮਿਹਨਤ ਲਗਾਉਣੀ ਚਾਹੀਦੀ ਹੈ ਅਤੇ ਲਾਈਫ ਦੇ ਵਿੱਚ ਕੁਛ ਨਾ ਕੁਛ ਵਧੀਆ ਕਰਨਾ ਚਾਹੀਦਾ ਹੈ ਲੋਕਾਂ ਦੀ ਭਲਾਈ ਵਾਸਤੇ